ਮੈਂ ਆਪਣੀ ਪਹਿਲੀ ਪਰੋਡਕਟ ਜੋ ਕਿ ਮੋਬਾਈਲ ਸੀ ਜੋ ਕਿ ਮੈਨੇ ਐਮਜ਼ੋਨ ਤੋਂ ਖਰੀਦਿਆ ਸੀ ਓਹਦੇ ਬਾਰੇ ਦੱਸਣਾ ਚਾਹੂੰਗੀ ਇਹ ਮੋਬਾਈਲ ਐੱਮ ਆਈ ਕੰਪਨੀ ਦਾ ਸੀ ਜੋ ਕਿ ਮੈਨੇ ਪੰਦਰਾਂ ਕੁ ਹਜ਼ਾਰ ਰੁਪਏ 'ਚ ਖਰੀਦਿਆ ਸੀ ਮੋਬਾਈਲ ਮੈਨੇ ਚਾਰ ਕੁ ਸਾਲ ਪਹਿਲਾਂ ਖਰੀਦੀਆ ਸੀ ਅਜੇ ਤੱਕ ਵੀ ਮੈਂ ਚਲਾ ਰਹੀ ਹਾਂ ਇਸ ਦੀ ਚਾਰ ਜੀ ਬੀ ਰੈਮ ਅਤੇ ਚੌਹਟ ਜੀ ਬੀ ਸਟੋਰੇਜ ਹੈ ਬੈਟਰੀ ਬੈਕਅੱਪ ਬਹੁਤ ਵਧੀਆ ਹੈ ਅਤੇ ਮੇਰਾ ਮੋਬਾਈਲ ਇੱਕ ਵਾਰ ਚਾਰਜ ਕਰਨ ਨਾਲ ਡੇਡ ਤੋਂ ਦੋ ਦਿਨ ਤੱਕ ਕੱਢ ਦਿੰਦਾ ਹੈ ਤੇਜ਼ ਚਾਰਚਿੰਗ ਦਾ ਵਿਕਲਪ ਵੀ ਇਸ ਫੋਨ ਵਿੱਚ ਉਪਲੱਬਧ ਹੈ ਇਸ ਮੋਬਾਈਲ ਦਾ ਕੈਮਰਾ ਬਹੁਤ ਹੀ ਵਧੀਆ ਹੈ ਇਹ ਮੋਬਾਈਲ ਕਦੇ ਵੀ ਹੈਂਗ ਨਹੀਂ ਹੁੰਦਾ ਹੈ ਇਸ ਮੋਬਾਈਲ 'ਚ ਕਾਫੀ ਚੰਗੇ ਫੀਚਰ ਹਨ ਜਿਵੇਂ ਕਿ ਐਪ ਲੋਕ ਹੈ ਫੇਸ ਲੋਕ ਹੈ ਅਤੇ ਬਾਇਓਮੈਟਰਿਕ ਫਿੰਗਰ ਸਕੈਨਰ ਵੀ ਉਪਲਬਧ ਹੈ ਇੱਕ ਹੋਰ ਇਸ ਵਿੱਚ ਸਹੂਲਤ ਹੈ ਕਿ ਰਿਮੋਰਟ ਕੰਟਰੋਲ ਜੋ ਕਿ ਇਸ ਮੋਬਾਈਲ ਨੂੰ ਦੂਜੇ ਮੋਬਾਈਲਾਂ ਨਾਲ ਵੱਖ ਕਰਦੀ ਹੈ ਦੋ ਸਾਲ ਲੋਕ ਡਾਊਨ ਦੇ ਵਿੱਚ ਮੈਂ ਆਪਣੀ ਬੇਟੀ ਨੂੰ ਇਸ ਫੋਨ ਤੋਂ ਓਨਲਾਈਨ ਕਲਾਸਿਸ ਵੀ ਲਗਵਾਈਆਂ ਅਤੇ ਉਸਦਾ ਸਾਰਾ ਕੰਮ ਜੋ ਸਕੂਲ ਦਾ ਸੀ ਉਹ ਔਨਲਾਈਨ ਹੀ ਆਉਂਦਾ ਸੀ ਇਹ ਮੋਬਾਈਲ ਮੇਰਾ ਬੇਟਾ ਵੀ ਚਲਾਉਂਦਾ ਹੈ ਉਹ ਇਸ ਮੋਬਾਈਲ ਵਿੱਚ ਕਾਫੀ ਸਾਰੀਆਂ ਗੇਮਸ ਖੇਡਦਾ ਹੈ ਜਿਵੇਂ ਕਿ ਟੋਕਿੰਗ ਟੋਮ ਕੈਂਡੀ ਕਰੱਸ਼ ਆਦਿ ਇਸ ਮੋਬਾਈਲ ਵਿੱਚ ਅਸੀਂ ਫੈਮਲੀ ਦਾ ਵਟਸਐਪ ਗਰੁੱਪ ਬਣਾਇਆ ਹੋਇਆ ਹੈ ਅਤੇ ਇੱਕ ਦੂਜੇ ਨੂੰ ਤਿਉਹਾਰਾਂ 'ਤੇ ਵੀਡੀਓ ਕੋਲ ਕਰਦੇ ਹਾਂ ਅਤੇ ਔਨਲਾਈਨ ਚੈਟਿੰਗ ਵੀ ਕਰਦੇ ਹਾਂ ਉਹਨਾਂ ਨੂੰ ਤਿਉਹਾਰਾਂ 'ਤੇ ਸੰਦੇਸ਼ ਵੀ ਭੇਜਦੇ ਹਾਂ ਇਸ ਤਰ੍ਹਾਂ ਇਸ ਮੋਬਾਈਲ ਨੂੰ ਅਸੀਂ ਆਪਣੇ ਫੈਮਲੀ ਵਿੱਚ ਆਪਣੇ ਪਰਿਵਾਰ ਵਿੱਚ ਇੱਕ ਦੂਜੇ ਨਾਲ ਗੱਲ ਬਾਤ ਕਰਨ ਦਾ ਸਾਧਨ ਬਣਾਇਆ ਹੋਇਆ ਹੈ